ਹੈਲੋ ਹਾਂਜੀ ਰਾਮ ਰਾਮ ਜੀ ਕੀ ਕੀ ਕਰਦੇ ਪਏ ਰੋਟੀ ਪਾਣੀ ਖਾ ਪਕਾ ਲਿਆ

ਅੱਜ ਮੈਨੂੰ ਇੱਕ ਖਬਰ ਮਿਲੀ ਆ ਕਿ ਇੱਥੇ ਅੰਮ੍ਰਿਤਸਰ 'ਚ ਸ਼ੂਟਿੰਗ ਚੱਲਦੀ ਪਈ ਸੰਜੇ ਦੱਤ ਅਤੇ ਕੈਟਰੀਨਾ ਕੈਫ ਆਏ ਹੋਏ ਹੈ ਕਹਿੰਦੇ ਬੜਾ ਰਸ਼ ਓਹ ਮੇਰੀ ਬੇਟੀ ਆਈ ਨਾ ਕੋਲੇਜ ਤੋਂ ਉਹਨੇ ਦੱਸਿਆ ਮੈਨੂੰ ਅਤੇ ਉਹ ਕਹਿੰਦੀ ਉਹ ਕਹਿੰਦੀ ਮੰਮਾ ਮੈਂ ਤਾਂ ਚੱਲੀ ਹਾਂ ਤੁਸੀਂ ਵੀ ਦੇਖ ਆਈਓ ਚੱਲੀਏ ਸ਼ਾਮੀ ਜਦੋਂ ਤੁਸੀਂ ਵਿਹਲੇ ਹੋ ਜੇ ਹੁਣ ਵਿਹਲੇ ਤਾਂ ਹੁਣੇ ਚੱਲ ਪਓ ਮੈਂ ਵੀ ਵਿਹਲੀ ਹਾਂ ਇੱਧਰ ਹੀ ਆਏ ਹੋਏ ਬਾਗ ਵਾਲੀ ਗਲੀ ਅਤੇ ਜੈ ਸਿੰਘ ਚੌਂਕ ਹੀ ਸ਼ੂਟਿੰਗ ਹੁੰਦੀ ਪਈ ਹੈ ਅਤੇ ਪੈਦਲ ਚਲੇ ਜਾਂਦੇ ਚਲੋ ਤਿਆਰ ਹੋ ਜਾਓ ਫਿਰ ਮੈਂ ਤੁਹਾਨੂੰ ਕਰਦੀ ਹਾਂ ਫ਼ੋਨ ਠੀਕ ਹੈ ਜਾਂ ਤੁਸੀਂ ਜੇ ਪਹਿਲਾਂ ਤਿਆਰ ਹੋ ਗਏ ਤਾਂ ਤੁਸੀਂ ਕਰ ਦਿਓ ਫ਼ੋਨ ਚਲੋ ਠੀਕ ਹੈ ਰਾਮ ਰਾਮ ਜੀ